ਸਾਡੇ ਪਿੰਡ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਕਿ ਮੁੱਖ ਅਤੇ ਮੇਰੀ ਮਨਪਸੰਦੀ ਦਾ ਖੋ ਖੋ ਵਾਲੀ ਖੇਡ ਹੈ ਜਿਸ ਨੂੰ ਕਿ ਆਪਾਂ ਇਸ ਦੇ ਰੂਲਸ ਇਹ ਹਨ ਕਿ ਅ ਟੀਮ ਪੂਰੀ ਬੈ ਜਮੀਨ 'ਤੇ ਬੈਠਦੀ ਹੈ ਖੇਡ ਵਾਲੇ ਮੈਦਾਨ ਵਿੱਚ ਅਤੇ ਇੱਕ ਬੰਦਾ ਜਿਹੜਾ ਹੈ ਉਹ ਸਿੱਧਾ ਬੈਠਾ ਹੁੰਦਾ ਹੈ ਅਤੇ ਦੂਸਰਾ ਬੰਦਾ ਉਸੇ ਹੀ ਕਤਾਰ ਦੇ ਵਿੱਚ ਪੁੱਠਾ ਬੈਠਾ ਹੁੰਦਾ ਹੈ ਅਤੇ ਫਿਰ ਜਿਹੜਾ ਬੰਦਾ ਨੂੰ ਪਿੱਠ ਲਗਾ ਦਿੱਤੀ ਜਾਵੇ ਉਸ 'ਤੇ ਪਿੱਠ 'ਤੇ ਹੱਥ ਰੱਖ ਦਿੱਤਾ ਜਾਵੇ ਤਾਂ ਉਸਨੇ ਉੱਠ ਕੇ ਦੂਸਰੇ ਬੰਦੇ ਨੂੰ ਫੜਨਾ ਹੁੰਦਾ ਹੈ ਤਾਂ ਉਹ ਜਦੋਂ ਅਸੀਂ ਉਸਨੂੰ ਪਿੱਠ ਲਗਾਉਂਦੇ ਹਾਂ ਤਾਂ ਇਸਦਾ ਭਾਵ ਕਿ ਅਸੀਂ ਉਹਨੂੰ ਖੋ ਦਿੰਦੇ ਹਾਂ ਜਿਸ ਜਿਹਨੂੰ ਅਸੀਂ ਖੋ ਦੇ ਦਿੱਤੀ ਹੈ ਤਾਂ ਉਹ ਫਿਰ ਜਿਸ ਨੂੰ ਪਿੱਠ ਲੱਗਦੀ ਹੈ ਉਹ ਤਾਂ ਉਹ ਉੱਠ ਕੇ ਦੂਸਰੇ ਬੰਦੇ ਨੂੰ ਦੌੜਦਾ ਹੋਇਆ ਫੜਦਾ ਹੈ ਅਤੇ ਉਹ ਵਿੱਚੋਂ ਦੀ ਵੀ ਨਿਕਲ ਸਕਦਾ ਹੈ ਅਤੇ ਉਸ ਨੂੰ ਫੜਨ ਵਾਸਤੇ ਕਿਸੇ ਵੀ ਕਤਾਰ ਦੇ ਵਿੱਚ ਬੈਠੇ ਹੋਏ ਬੰਦੇ ਨੂੰ ਵੀ ਖੋ ਲਗਾ ਕੇ ਫਿਰ ਉਸਨੂੰ ਫਟਾਫਟ ਫੜਨ ਵਾਸਤੇ ਖੋ ਦੇ ਸਕਦਾ ਹੈ